ਵੈਸੇ ਤਾਂ ਮੈਨੂੰ ਮੱਛੀਆਂ ਬਹੁਤ ਵਧੀਆ ਲੱਗਦੀਆਂ ਹੈਗੀਆਂ ਇਹਨਾਂ 'ਚੋਂ ਮੈਨੂੰ ਅੰਮ੍ਰਿਤਸਰੀ ਪਰਚ ਅਤੇ ਇੱਦਾਂ ਦੀਆਂ ਕੈਟਾਗਰੀ ਮੈਨੂੰ ਬਹੁਤ ਵਧੀਆ ਲੱਗਦੀਆਂ ਹੈਗੀਆਂ ਇਹਨਾਂ ਦੀਆਂ ਮੱਛੀਆਂ ਦੀਆਂ ਦੇਖਣ ਨੂੰ ਵੀ ਵਧੀਆ ਲੱਗਦੀਆਂ ਹੈਗੀਆਂ ਇੱਦਾਂ ਇਹ ਅਤੇ ਜਦ ਆਪਾਂ ਘੁੰਮਦੇ ਹੁੰਦੇ ਹਾਂ ਇੱਥੇ ਸਾਡੇ ਇੱਕ ਪਿੰਡ 'ਚ ਹੀ ਮੁੰਡੇ ਨੇ ਮੱਛੀ ਪਾਲਣ ਸ਼ੁਰੂ ਕੀਤਾ ਵਾ ਹੈਗਾ ਹੈ ਉਹਨੇ ਵੀ ਮਤਲਬ ਇਹੀ ਕੈਡ ਇਹੀ ਕੈਂਡਸ ਦੀਆਂ ਮੱਛੀਆਂ ਰੱਖੀਆਂ ਹੋਈਆਂ ਆਪਣੇ ਕੋਲ